ਅਸੀਂ ਖੁੱਲ੍ਹੇ ਭਾਂਡੇ ਵਿੱਚ ਪਕਾਏ ਹੋਏ ਭੋਜਨ ਨੂੰ ਤਰਜੀਹ ਦਿੰਦੇ ਹਾਂ ਕਿਉਂਕਿ ਇਹਨਾਂ ਵਿੱਚ ਬਣਾਇਆ ਹੋਇਆ ਭੋਜਨ ਬਹੁਤ ਸਵਾਦ ਬਣਦਾ ਹੈ ਅਤੇ ਨਾਲ ਇਹਦੇ ਵਿੱਚ ਭੋਜਨ ਜਲਦਾ ਨਹੀਂ ਅਤੇ ਬਹੁਤ ਹੀ ਸਵਾਦ ਅਤੇ ਪੋਸ਼ਟਿਕ ਬਣਦਾ ਹੈ ਇਹਦੇ ਵਿੱਚ ਬਣਾਇਆ ਗਿਆ ਭੋਜਨ ਦੇ ਜੋ ਵਿਟਾਮਿਨ ਹੁੰਦੇ ਨੇ ਉਹ ਸਾਰੇ ਹੀ ਚੰਗੇ ਅਤੇ ਚੰਗੇ ਰਹਿ ਜਾਂਦੇ ਅਤੇ ਵਧੀਆ ਵਧੀਆ ਰਹਿ ਜਾਂਦੇ ਹਨ ਅਤੇ ਇਸ ਕਰਕੇ ਖੁੱਲ੍ਹੇ ਭਾਂਡੇ ਵਿੱਚ ਅਸੀਂ ਭੋਜਨ ਬਣਾਉਂਦੇ ਹਾਂ ਅਤੇ ਹੋਰ ਕਦੇ ਵਾਰੀ ਜ਼ਿਆਦਾ ਲੋੜ ਪੈਣ 'ਤੇ ਵੀ ਅਸੀਂ ਕੁੱਕਰ ਨੂੰ ਇਸਤੇਮਾਲ ਕਰ ਪ ਲੈਂਦੇ ਹਾਂ ਜਦੋਂ ਸਾਨੂੰ ਜ਼ਿਆਦਾ ਲੋੜ ਹੁੰਦੀ ਹੈ ਨਹੀਂ ਤਾਂ ਅਸੀਂ ਖੁੱਲ੍ਹੇ ਭਾਂਡੇ ਨੂੰ ਹੀ ਯੂਜ ਕਰਦੇ ਹਾਂ ਇਹਦੇ ਵਿੱਚ ਖਾਣਾ ਬਹੁਤ ਹੀ ਵਧੀਆ ਅਤੇ ਚੰਗਾ ਬਣਦਾ ਹੈ ਜਿਹੜਾ ਸਾਡੇ ਸਰੀਰ ਦੇ ਖਾਣ ਦੇ ਯੋਗ ਹੁੰਦਾ ਹੈ